ਹੈਲੋ ਹਾਂਜੀ ਕਰ ਰਹੀ ਹਾਂ

ਹਾਂਜੀ ਹਾਂਜੀ ਰਹਿੰਦੀ ਹਾਂ ਹਾਂਜੀ ਤੁਸੀਂ ਕਿਹੜੀ ਕਿਸ ਟਾਈਪ ਦੀ ਪਲੇਸ ਵਿਜ਼ਿਟ ਕਰਨਾ ਚਾਹੁੰਦੇ ਹੋ ਪਟਿਆਲੇ 'ਚ ਅਤੇ ਤੁਸੀਂ ਮਤਲਬ ਕਿਵੇਂ ਜਿਵੇਂ ਕਿ ਗੁਰਦੁਆਰਾ ਹੋ ਗਿਆ ਜਾਂ ਕੋਈ ਹੋਰ ਪਲੇਸ ਕਿਵੇਂ ਦੀ ਪਲੇਸਿਸ 'ਚ ਵਿਜ਼ਿਟ ਕਰੋਂਗੇ ਅੱਛਾ ਜੀ ਹਾਂਜੀ ਇੱਥੇ ਬਹੁਤ ਸਾਰੇ ਗੁਰਦੁਆਰੇ ਨੇ ਮੈਂ ਤੁਹਾਨੂੰ ਜ਼ਰੂਰ ਦੱਸੂੰਗੀ ਇੱਥੇ ਜਿਹੜਾ ਸਭ ਤੋਂ ਫੇਮਸ ਗੁਰਦੁਆਰਾ ਦੂਖਨਿਵਾਰਨ ਸਾਹਿਬ ਹੈ ਇੱਥੇ ਜਿਹੜੇ ਸ਼ਰਧਾਲੂ ਹਰੇਕ ਸਾਲ ਆਉਂਦੇ ਨੇ ਇੱਥੇ ਮੱਥਾ ਟੇਕਦੇ ਨੇ ਇੱਥੇ ਪੰਚਮੀਆਂ ਨਹਾ ਕੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਗੁਰਦੁਆਰਾ ਜਿਹੜਾ ਦੁੱਖਾਂ ਦਾ ਨਾਸ਼ ਕਰਦਾ ਦੁੱਖਾਂ ਨੂੰ ਕੱਟਦਾ ਅਤੇ ਬਾਕੀ ਉਹ ਇੱਕ ਉਹ ਮੋਤੀ ਬਾਗ ਗੁਰਦੁਆਰਾ ਸਾਹਿਬ ਵੀ ਹੈ ਇੱਥੇ ਕਿਹਾ ਜਾਂਦਾ ਹੈ ਕਿ ਜਿਹੜੇ ਆਪਣੇ ਨੌਵੇਂ ਪਾਤਸ਼ਾਹੀ ਜੀ ਸੀਗੇ ਉਹ ਇੱਥੇ ਆਏ ਸੀਗੇ ਕੁਝ ਦਿਨ ਲਾ ਕੇ ਗਏ ਸੀ ਤਾਂ ਕਰਕੇ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਇੱਥੇ ਸਥਾਪਿਤ ਕੀਤਾ ਗਿਆ ਅਤੇ ਬਾਕੀ ਇੱਕ ਬਹਾਦਰਗੜ੍ਹ ਸਾਹਿਬ ਬਹਾਦਰਗੜ੍ਹ ਨਿੰਮ ਸਾਹਿਬ ਗੁਰਦੁਆਰਾ ਹੈ ਅਤੇ ਉੱਥੇ ਕਹਿੰ ਕਹਿੰਦੇ ਨੇ ਵੀ ਕਿ ਉੱਥੇ ਨਿੰਮ ਮਿੱਠੇ ਨੇ ਉੱਥੇ ਨਿੰਮ ਕੌੜੇ ਨਹੀਂ ਹੈਗੇ ਅਤੇ ਬਾਕੀ ਕਲੌਰਾ ਸਾਹਿਬ ਗੁਰਦੁਆਰਾ ਇੱਥੇ ਵੀ ਬਹੁਤ ਮਾਨਯਤਾ ਪ੍ਰਾਪਤ ਹੈ ਇਸ ਗੁਰਦੁਆਰੇ ਨੂੰ ਵੀ ਅਤੇ ਤੁਸੀਂ ਹੋਰ ਕੀ ਸਿਰਫ਼ ਗੁਰਦੁਆਰਾ ਵਿਜ਼ਿਟ ਕਰਨਾ ਚਾਹੁੰਦੇ ਹੋ ਕਿ ਹੋਰ ਵੀ ਕੋਈ ਪਲੇਸ ਹਾਂਜੀ ਕੋਈ ਨਹੀਂ ਮੈਂ ਤੁਹਾਨੂੰ ਇਹ ਜੀ ਦੱਸ ਤੇ ਗੁਰਦੁਆਰੇ ਅਤੇ ਤੁਸੀਂ ਇੱਥੇ ਜ਼ਰੂਰ ਜਾ ਕੇ ਆਇਓ ਹਾਂਜੀ ਕੋਈ ਨਹੀਂ ਥੈਂਕ ਯੂ